ਪੰਜਾਬ ਦੀ ਧਰਤੀ ਤਿਉਹਾਰਾਂ ਅਤੇ ਮੇਲਿਆਂ ਦੀ ਧਰਤੀ ਹੈ ਇੱਥੇ ਕਾਫੀ ਤਿਉਹਾਰ ਮਨਾਏ ਜਾਂਦੇ ਹਨ ਇੱਥੇ ਲੋਕ ਬੜੇ ਭਾਈਚਾਰੇ ਨਾਲ ਹਰ ਇੱਕ ਤਿਉਹਾਰ ਨੂੰ ਬੜੇ ਧੂਮ ਧਾਮ ਨਾਲ ਮਨਾਉਂਦੇ ਹਨ ਅਸੀਂ ਪੰਜਾਬ ਵਿੱਚ ਹਰ ਤਿਉਹਾਰ ਮਨਾਇਆ ਜਾਂਦਾ ਇੱਥੇ ਕੋਈ ਵੀ ਧਰਮ ਦੇ ਲੋਕ ਹਰ ਧਰਮ ਦੇ ਲੋਕ ਰਹਿੰਦੇ ਹਨ ਹਰ ਵਿੱਚ ਸਾਰਿਆਂ ਵਿੱਚ ਭਾਈਚਾਰਕ ਭਾਵਨਾ ਹੈਗੀ ਹੈ ਹਰ ਕੋਈ ਹਰ ਤਿਉਹਾਰ ਨੂੰ ਮਨਾਉਂਦਾ ਉਹ ਵੀ ਬੜੇ ਧੂਮ ਧਾਮ ਤਰੀਕੇ ਨਾਲ ਕੋਈ ਇਹਦੇ ਵਿੱਚ ਵਿਲੱਖਣਤਾ ਨਹੀਂ ਹੈ ਕੋਈ ਕਿਸੇ ਵਿੱਚ ਭੇਦ ਭਾਵ ਨਹੀਂ ਕਰਦਾ ਕੋਈ ਵਿਤਕਰਾ ਵੀ ਨਹੀਂ ਕਰਦਾ ਅਸੀਂ ਕੁਝ ਉਦਾਹਰਣ ਵੀ ਲੈ ਸਕਦੇ ਹਾਂ ਜਿੱਦਾਂ ਕਿ ਜਦੋਂ ਅਸੀਂ ਦਿਵਾਲੀ ਦਾ ਤਿਉਹਾਰ ਮਨਾਉਂਦੇ ਹਾਂ ਤਾਂ ਇਹ ਸਾਰੇ ਧਰਮ ਦੇ ਲੋਕ ਮਨਾਉਂਦੇ ਹਨ ਇਹ ਅਤੇ ਕਾਫੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਇਹਦੇ ਪਿੱਛੇ ਕਹਾਣੀ ਵੀ ਹੈ ਕਿ ਕਹਿੰਦੇ ਹੈ ਕਿ ਜਿਹੜੇ ਰਾਮ ਭਗਵਾਨ ਆ ਉਹ ਚੋਦਾਂ ਸਾਲ ਦਾ ਬਨਵਾਸ ਕੱਟ ਕੇ ਜਦੋਂ ਆਏ ਸੀ ਤੇ ਤਾਂ ਦੀਵਾਲੀ ਦਾ ਤਿਉਹਾਰ ਮਨਾਇਆ ਜਾਂਦਾ ਇਸ ਦੇ ਵਿੱਚ ਰੰਗੋਲੀਆਂ ਬਣਾਈ ਜਾਂਦੀ ਹੈ ਅਤੇ ਪਟਾਕੇ ਚਲਾਏ ਜਾਂਦੇ ਆ ਪਰ ਪਟਾਕਿਆਂ ਨੂੰ ਨਹੀਂ ਚਲਾਉਣਾ ਚਾਹੀਦਾ ਕਿਉਂਕਿ ਨਾ ਪ੍ਰਦੂਸ਼ਣ ਵਗੈਰਾ ਵੀ ਬਹੁਤ ਹੁੰਦਾ ਅਤੇ ਇਸ ਤੋਂ ਇਲਾਵਾ ਅਸੀਂ ਹੋਰ ਗੱਲ ਕਰੀਏ ਤਾਂ ਅਸੀਂ ਹੋਲੀ ਦਾ ਤਿਉਹਾਰ ਵੀ ਕਹਿ ਸਕਦੇ ਹਾਂ ਹੋਲੀ ਦੇ ਤਿਉਹਾਰ ਵਿੱਚ ਰੰਗਾਂ ਦਾ ਤਿਉਹਾਰ ਹੁੰਦਾ ਹੈ ਇਹ ਆਪਾਂ ਜਦੋਂ ਇੱਕ ਦੂਜੇ ਨੂੰ ਲਗਾਉਂਦੇ ਹਾਂ ਤਾਂ ਇਹ ਸਾਡੀ ਭਾਵਨਾਵਾਂ ਦਾ ਉਹ ਦਰਸਾਉਂਦਾ ਹੈ ਅਤੇ ਸਾਡੇ ਵਿੱਚ ਆਪਸੀ ਭਾਈ ਭਾਈਚਾਰਾ ਉਹਨੂੰ ਅੱਗੇ ਦਰਸਾਉਂਦਾ